ਹੈਲੋ ਹਾਂ ਹਾਂਜੀ ਮੈਡਮ ਮੈਂ ਫਰੀਦਕੋਟ ਤੋਂ ਗੱਲ ਕਰ ਰਿਹਾ ਬੈਚਲਰਸ ਆਫ ਇੰਜੀਨਅਰਿੰਗ ਲਾਸਟ ਈਅਰ ਦਾ ਸਟੂਡੈਂਟ ਹਾਂ ਹੈਲੋ ਹਾਂਜੀ ਮੈਂ ਫਰੀਦਕੋਟ ਤੋਂ ਇੰਜੀਨੀਅਰਿੰਗ ਦਾ ਲਾਸਟ ਈਅਰ ਦਾ ਸਟੂਡੈਂਟ ਬੋਲ ਰਿਹਾ ਤੁਸੀਂ ਪਲੇਸਮੈਂਟ ਸੈੱਲ ਤੋਂ ਗੱਲ ਕਰਦੇ ਹੁਸ਼ਿਆਰਪੁਰ ਦੇ ਹਾਂ ਮੈਂ ਤੁਹਾਨੂੰ ਦੋ ਕੁਐਰੀਆਂ ਕਰਨੀਆਂ ਸੀਗੀਆਂ ਆਪਣੇ ਜੋਬ ਪਲੇਸਮੈਂਟ ਬਾਰੇ ਕਿਉਂਕਿ ਹੁਣ ਨੈਕਸਟ ਜਿਹੜਾ ਮੇਰੇ ਜਿਹੜੀ ਡਿਗਰੀ ਆ ਕੰਪਲੀਟ ਹੋ ਜਾਣੀ ਆ ਅਤੇ ਮੈਂ ਪੁੱਛਣਾ ਚਾਹੁੰਦਾ ਕਿ ਕਿਹੜੀ ਇੱਦਾਂ ਦੀ ਜਗ੍ਹਾ ਜਾਂ ਇੰਡਸਟਰੀ ਵਗੈਰਾ ਜਿੱਥੇ ਮੈਂ ਜੋਬ ਲੈ ਸਕਦਾ ਜਾਂ ਮੈਨੂੰ ਵਧੀਆ ਜੋਬ ਮਿਲ ਸਕਦੀ

ਮੈਂ ਇਹ ਕਹਿ ਰਿਹਾ ਸੀ ਕਿ ਸੋਨਾਲੀਕਾ ਦਾ ਮੈਂ ਬਹੁਤ ਨਾਂ ਸੁਣਿਆ ਉਹ ਵਧੀਆ ਪੈਕੇਜ ਦੇ ਦਿੰਦੇ ਆ ਕੀ ਉਹਨਾਂ ਦੀਆਂ ਸਹੂਲਤਾਂ ਵਗੈਰਾ ਕੀ ਆ ਉਹਨਾਂ ਦੀ

ਠੀਕ ਅਤੇ ਮਤਲਬ ਟਰਾਂਸਪੋਰਟੇਸ਼ਨ ਵਗੈਰਾ ਜੇ ਮੈਂ ਕਿੱਦਾਂ ਸ਼ਹਿਰ ਤੋਂ ਕਹਿੰਦੇ ਬਾਹਰ ਆ ਜਿਹੜੀ ਸੋਨਾਲੀਕਾ ਤਾਂ ਮੈਂ ਕਿੱਦਾਂ ਆ ਸਕਦਾ ਉੱਥੇ ਆ ਜਾ ਸਕਦਾ ਨਹੀਂ ਨਹੀਂ ਮੈਂ ਐਜ਼ ਆ ਪੇਇੰਗ ਗੈਸਟ ਰਹੂੰਗਾ ਹੁਸ਼ਿਆਰਪੁਰ 'ਚ ਸਿਟੀ ਦੇ ਵਿੱਚ ਰਹੂੰਗਾ

ਓਕੇ ਥੈਂਕ ਯੂ ਬਹੁਤ